ਅੱਜ ਦੇ ਸਮੇਂ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਬਿਮਾਰੀਆਂ ਨੇ ਜਿਵੇਂ ਕਿ ਬੁਖ਼ਾਰ ਡੇਂਗੂ ਚਿਕਨਗੁਨੀਆ ਅਤੇ ਛੂਤਛਾਤ ਦੀ ਬਿਮਾਰੀ ਇਹ ਹੁੰਦੀ ਸੀ ਵੀ ਜਿਵੇਂ ਕਿ ਕਿਸੇ ਨੂੰ ਛੂਹ ਲਿਆ ਅਤੇ ਉਹਦੇ ਨਾਲ਼ ਉਹਨੂੰ ਬਿਮਾਰੀ ਪੈਦਾ ਹੋ ਜਾਂਦੀ ਸੀ ਅਤੇ ਉਹਦੇ ਨਾਲ਼ ਇੱਕ ਨੂੰ ਬਿਮਾਰ ਹੁੰਦਾ ਤੀ ਅਤੇ ਉਹਦੇ ਨਾਲ਼ ਦੂਜੇ ਬੰਦੇ ਨੂੰ ਦੂਜੇ ਤੋਂ ਬਾਅਦ ਤੀਜੇ ਬੰਦੇ ਨੂੰ ਉਹਦਾ ਕਾਰਨ ਕੀ ਤੀ ਜਦੋਂ ਅਸੀਂ ਛਿੱਕਦੇ ਹਾਂ ਸਾਹ ਲੈਂਦੇ ਹਾਂ ਜਾਂ ਸਾਹ ਛੱਡਦੇ ਹਾਂ ਉਹ ਹਵਾ ਦੇ ਵਿੱਚ ਮਿਲ ਕੇ ਛੂਤਛਾਤ ਦੀਆਂ ਬਿਮਾਰੀਆਂ ਪੈਦਾ ਕਰਦਾ ਸੀ